ਸਾਡੇ ਪਰਿਵਾਰ ਦੇ ਵਿੱਚ ਬਹੁਤ ਸਾਰੀਆਂ ਸੱਭਿਆਚਾਰੀਆਂ ਪ੍ਰੰਪਰਾਂ ਹਨ ਜਦੋਂ ਬੱਚਾ ਜਨਮ ਲੈਂਦਾ ਹੈ ਬਾਣੀ ਪੜ੍ਹੀ ਜਾਂਦੀ ਹੈ ਨਿਤਨੇਮ ਕੀਤਾ ਜਾਂਦਾ ਹੈ ਚੌਪਈ ਸਾਹਿਬ ਦਾ ਪਾਠ ਕੀਤਾ ਜਾਂਦਾ ਹੈ ਛੇ ਬਾਣੀਆਂ ਆਨੰਦ ਸਾਹਿਬ ਦੀਆਂ ਕੀਤੀਆਂ ਜਾਂਦੀਆਂ ਨੇ ਅਤੇ ਉਹ ਤੋਂ ਬਾਅਦ ਪਤਾਸੇ ਇੱਕ ਬਾਟੇ ਦੇ ਵਿੱਚ ਘੋਲ ਕੇ ਬੱਚੇ ਨੂੰ ਖੰਡੇ ਬਾਟੇ ਦੀ ਪਾਹੁਲ ਛਕਾਈ ਜਾਂਦੀ ਹੈ ਉਹ ਤੋਂ ਬਾਅਦ ਗੁਰੂ ਸਾਹਿਬ ਦੀ ਮਰਿਆਦਾ ਅਨੁਸਾਰ ਬੱਚੇ ਦਾ ਨਾਮਕਰਨ ਕੀਤਾ ਜਾਂਦਾ ਹੈ ਅਤੇ ਹੁਕਮਨਾਮਾ ਲਿਆ ਜਾਂਦਾ ਹੈ ਓਹਦੇ 'ਚੋਂ ਇੱਕ ਬੱਚੇ ਦਾ ਅੱਖਰ ਦੱਸਿਆ ਜਾਂਦਾ ਹੈ ਜੋ ਗੁਰੂ ਸਾਹਿਬ ਦੇ ਵਜ਼ੀਰ ਨੇ ਉਹ ਦੱਸਦੇ ਨੇ ਜੋ ਵੀ ਅੱਖਰ ਨਿਕਲਦਾ ਹੈ ਹੁਕਮ ਅਨੁਸਾਰ ਸਤਿਗੁਰ ਮਹਾਰਾਜ ਦੀ ਬਾਣੀ ਦੇ ਅਨੁਸਾਰ ਜਿਉਂ ਜਿਉਂ ਬੱਚਾ ਵੱਡਾ ਹੁੰਦਾ ਹੈ ਬੱਚੇ ਦਾ ਵਿਆਹ ਰਚਾਇਆ ਜਾਂਦਾ ਉਹ ਵੀ ਗੁਰੂ ਸਾਹਿਬ ਦੀ ਮਰਿਆਦਾ ਅਨੁਸਾਰ ਸਤਿਗੁਰ ਮਹਾਰਾਜ ਦਾ ਸਰੂਪ ਅਸੀਂ ਘਰੇ ਲੈ ਕੇ ਆਉਂਦੇ ਹਾਂ ਅਖੰਡ ਪਾਠ ਸਾਹਿਬ ਕਰਵਾਉਂਦੇ ਹਾਂ ਸਾਰਾ ਪਰਿਵਾਰ ਸਮੇਤ ਗੁਰੂ ਸਾਹਿਬ ਦੀ ਸੇਵਾ ਕਰਦੇ ਨੇ ਤਨੁ ਮਨੁ ਦੇ ਨਾਲ ਬਾਣੀ ਪੜ੍ਹੀ ਜਾਂਦੀ ਹੈ ਘਰ ਦੇ ਵਿੱਚ ਜਦੋਂ ਵਿਆਹ ਰਚਾਇਆ ਜਾਂਦਾ ਦੋ ਪਰਿਵਾਰਾਂ ਦਾ ਮੇਲ ਹੁੰਦਾ ਅਤੇ ਗੁਰੂ ਸਾਹਿਬ ਦੀ ਮਰਿਆਦਾ ਅਨੁਸਾਰ ਹੀ ਆਨੰਦ ਕਾਰਜ ਕੀਤੇ ਜਾਂਦੇ ਨੇ ਉਹ ਤੋਂ ਬਾਅਦ ਜਿਹੜੇ ਸਾਡੇ ਸੱਭਿਆਚਾਰ ਦੇ ਵਿੱਚ ਆਉਂਦਾ ਸਾਡੇ ਅਨੰਦਪੁਰ ਸਾਹਿਬ ਹੋਲਾ ਮਹੱਲਾ ਮਨਾਇਆ ਜਾਂਦਾ ਦੁਨੀਆਂ ਦੂਰ ਦੂਰ ਤੋਂ ਨਤਮਸਕਤ ਕਰਨ ਆਉਂਦੀ ਹੈ ਸਤਿਗੁਰੂ ਮਹਾਰਾਜ ਮੇਰੇ ਬਾਜਾਂ ਵਾਲੇ ਪਿਤਾ ਨੇ ਇਹ ਪੰਥ ਖਾਲਸਾ ਜਿਹੜਾ ਰਚਾਇਆ ਅਨੰਦਪੁਰ ਸਾਹਿਬ ਪੰਥ ਖਾਲਸਾ ਦੀ ਸਾਜਨਾ ਕੀਤੀ ਸੀ ਸੋਲਾਂ ਸੌ ਨੜਿੱਨਵੇ ਵਿਸਾਖੀ ਵਾਲੇ ਦਿਨ ਸੋ ਇੱਥੇ ਸ਼ਹੀਦੀ ਦਿਹਾੜੇ ਵੀ ਸਮਾਗਮ ਵੀ ਮਨਾਏ ਜਾਂਦੇ ਨੇ ਜਿੱਥੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਸਿੱਖ ਕੌਮ ਦੇ ਲਈ ਆਪਣੇ ਚਾਰ ਪੁੱਤਰ ਸਿੱਖ ਕੌਮ ਦੇ ਲਈ ਕੁਰਬਾਨ ਕਰ ਦਿੱਤੇ ਆਪਣਾ ਆਪ ਵਾਰ ਦਿੱਤਾ ਸਾਰਾ ਪਰਿਵਾਰ ਵਾਰ ਦਿੱਤਾ ਸੋ ਸਿੱਖ ਕੌਮ ਦੀ ਬੜੀ ਮਤਲਬ ਇੱਕ ਬਹੁਤ ਵੱਡੀ ਮਤਲਬ ਇੱਕ ਜਿਹੜਾ ਇਤਿਹਾਸ ਹੈ ਸਾਡਾ ਸੱਭਿਆਚਾਰ ਹੈ ਜੋ ਪੰਜਾਬੀ ਦੇ ਨਾਲ ਜੁੜਿਆ ਹੋਇਆ ਹੈ ਇਹ ਸਤਿਗੁਰੂ ਮਹਾਰਾਜ ਨੇ ਬੜੀ ਅਪਾਰ ਕ੍ਰਿਪਾ ਕੀਤੀ ਹੈ